ਪੰਜਾਬ ਵਿੱਚ ਪ੍ਰਮੁੱਖ ਰੂਪ ਵਿੱਚ ਹਿੰਦੂ ਸਿੱਖ ਮੁਸਲਿਮ ਈਸਾਈ ਜਿਹੜੇ ਧਾਰਮਿਕ ਜਿਹੜੇ ਲੋਕ ਨੇਗੇ ਮਿਲ ਜੁਲ ਕੇ ਰਹਿੰਦੇ ਨੇ ਅਤੇ ਸਿੱਖ ਨੇ ਜਿੱਦਾਂ ਉਹਨੂੰ ਆਪਣੇ ਦਸ ਗੁਰੂ ਸਾਹਿਬਾਨ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦੇ ਨੇ ਇਸ ਤਰ੍ਹਾਂ ਜਿਹੜੇ ਹਿੰਦੂ ਨੇ ਉਹ ਆਪਣੇ ਦੇਵੀ ਦੇਵਤਿਆਂ ਨੂੰ ਮੰਨਦੇ ਹੋਏ ਉਹਨਾਂ ਦੀ ਉਪਾਸਨਾ ਕਰਦੇ ਨੇ ਇਸੇ ਤਰ੍ਹਾਂ ਹੀ ਮੁਸਲਿਮ ਵਰਗ ਆ ਜਿਹੜਾ ਉਹ ਆਪਣੇ ਅੱਲ੍ਹਾ ਨੂੰ ਮੰਨਦਾ ਹੈ ਅਤੇ ਆਪਣੇ ਅੱਲ੍ਹਾ ਦੇ ਵਿੱਚ ਵਿਸ਼ਵਾਸ ਇੱਕ ਅੱਲ੍ਹਾ ਦੇ ਵਿੱਚ ਵਿਸ਼ਵਾਸ ਰੱਖਦਾ ਅਤੇ ਇਸੇ ਤਰ੍ਹਾਂ ਹੀ ਆ ਗਏ ਈਸਾਈ ਈਸਾਈਆਂ ਦਾ ਵੀ ਕੁਛ ਕੁਛ ਗਿਣਤੀ ਵਿੱਚ ਜਿਹੜੇ ਈਸਾਈ ਨੇਗੇ ਉਹ ਪੰਜਾਬ ਦੇ ਵਸਨੀਕ ਹੈ ਨੇ ਪਰ ਇਹ ਸਾਰੇ ਹੀ ਧਰਮ ਪੰਜਾਬ ਦੇ ਵਿੱਚ ਮਿਲ ਜੁਲ ਕੇ ਇੱਕ ਭਾਈਚਾਰੇ ਦੇ ਰੂਪ ਵਿੱਚ ਰਹਿ ਰਹੇ ਨੇ ਕੁਛ ਤਿਉਹਾਰ ਵੀ ਸਾਡੇ ਬੜੇ ਸਾਂਝੇ ਨੇ ਜਿਸ ਤਰ੍ਹਾਂ ਅਸੀਂ ਗੱਲ ਕੀਤੀ ਸੀ ਕਿ ਦਿਵਾਲੀ ਦੀ ਦਿਵਾਲੀ ਹਿੰਦੂਆਂ ਅਤੇ ਸਿੱਖਾਂ ਦਾ ਜਿਹੜਾ ਉਹ ਇੱਕ ਸਾਂਝਾ ਤਿਉਹਾਰ ਆ ਹਿੰਦੂ ਵੀ ਉਸੇ ਦਿਨ ਹੀ ਦਿਵਾਲੀ ਮਨਾਉਂਦੇ ਨੇ ਅਤੇ ਸਿੱਖ ਵੀ ਉਸੇ ਤਰ ਉਸੇ ਦਿਨ ਦਿਨ ਹੀ ਅਤੇ ਉਸੇ ਤਰ੍ਹਾਂ ਹੀ ਦਿਵਾਲੀ ਮਨਾਉਂਦੇ ਨੇ ਪਰ ਦੋਨਾਂ ਦੇ ਜਿਹੜੇ ਪਿੱਛੇ ਧਾਰਨਾਵਾਂ ਨੇਗੀਆਂ ਧਾਰਮਿਕ ਉਹ ਵੱਖ ਵੱਖ ਨੇਗੀਆ ਇਸ ਜਿਹੜੇ ਸਾਡੇ ਸਾਰੇ ਜਿਹੜੇ ਭਾਈਚਾਰੇ ਨੇ ਪੰਜਾਬ ਦੇ ਵਿੱਚ ਉਹ ਮਿਲ ਜੁਲ ਕੇ ਰਹਿੰਦੇ ਹਨ